ਹਾਂਜੀ ਸਾਰਿਆਂ ਨੂੰ ਪਤਾ ਵੀ ਯੋਗਾ ਸਰੀਰ ਲਈ ਵਧੀਆ ਹੈ ਸਰੀਰ ਦੀ ਫਲੈਕਸੀਬਿਲਟੀ ਵਧਦੀ ਹੈ ਤੇ ਸਰੀਰ ਨੂੰ ਬੈਨੀਫਿਟ ਹੁੰਦਾ ਹੈ ਲੇਕਿਨ ਇੱਕੋ ਦਮ ਸਾਰੇ ਆਸਨ ਜਿਹੜੇ ਹੈ ਉਹ ਹਰ ਕੋਈ ਬੰਦਾ ਨਹੀਂ ਕਰ ਸਕਦਾ ਹੌਲੀ ਹੌਲੀ ਸਾਨੂੰ ਸਿੱਖਣੇ ਪੈਂਦੇ ਨੇ ਤੇ ਹੌਲੀ ਹੌਲੀ ਬਾਡੀ ਦੀ ਫਲੈਕਸੀਬਿਲਟੀ ਵਧਦੀ ਹੈ ਤਾਂ ਇਸ ਤਰੀਕੇ ਨਾਲ ਮੈਂ ਇੱਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਵੀ ਅਸੀਂ ਪਹਿਲੀ ਦਿਨ ਯੋਗਾ ਦੀ ਕਲਾਸ ਤੇ ਗਏ

ਲੇਕਿਨ ਮੇਰੇ ਨਾਲ ਇੱਕ ਮੇਰੇ ਸਾਥੀ ਜਿਹੜੇ ਹੈਗੇ ਸੀਗੇ ਉਹ ਜਿਆਦਾ ਜੋਸ਼ ਚ ਆ ਗਏ ਉਹ ਜਿਆਦਾ ਬੈਂਡ ਹੋ ਗਏ ਤੇ ਜਿੰਨਾ ਕੁ ਉਹਦੀ ਸਮਰੱਥਾ ਸੀ ਉਸ ਤੋਂ ਜਿਆਦਾ ਬੈਂਡ ਹੋ ਗਏ ਤੇ ਉਹ ਅਚਾਨਕ ਨੀਚੇ ਗਿਰ ਗਏ ਸਾਰੇ ਇੱਕਦਮ ਰੁਕ ਗਏ ਕੁਛ ਲੋਕ ਬਹੁਤ ਹੱਸੇ ਵੀ ਲੇਕਿਨ ਚਲੋ ਉਹਨਾਂ ਨੂੰ ਕੋਈ ਚੋਟ ਨਹੀਂ ਆਈ ਤਾਂ ਉਹ ਜਿਹੜਾ ਕਿੱਸਾ ਹੈਗਾ ਮੈਨੂੰ ਹਮੇਸ਼ਾ ਯਾਦ ਰਹਿੰਦਾ ਤੇ ਯੋਗਾ ਕਰਨ ਵਾਲੇ ਹਰ ਬੰਦੇ ਨੂੰ ਮੈਂ ਸੁਣਾਉਨਾ ਵੀ ਤੁਸੀਂ ਜਿਹੜਾ ਯੋਗਾ ਇਕਦਮ ਜਿਹੜਾ ਜਿਆਦਾ ਨਹੀਂ ਕਰਨਾ ਕਈ ਵਾਰ ਕੋਈ ਨਾ ਕੋਈ ਫਾਇਦੇ ਦੀ ਜਗਹਾ ਤੇ ਨੁਕਸਾਨ ਵੀ ਹੋ ਸਕਦਾ ਇਸ ਕਰਕੇ ਹੌਲੀ ਹੌਲੀ ਆਪਣੀ ਬਾਡੀ ਦੀ ਜਿਹੜੀ ਫਲੈਕਸੀਬਿਲਿਟੀ ਆ ਉਹਨੂੰ ਇਮਪਰੂਵ ਕਰਨਾ ਉਸਨੂੰ ਸੁਧਾਰ ਕਰਨਾ ਉਸਨੂੰ ਵਧਾਉਣਾ ਤਾਂ ਫਿਰ ਜਿਹੜੀ ਯੋਗਾ ਜਿਹੜਾ ਅੱਛੀ ਤਰ੍ਹਾਂ ਜਿਹੜਾ ਤੁਹਾਡੀ ਬਾਡੀ ਨੂੰ ਜਿਹੜਾ ਸੂਟ ਕਰੂਗਾ ਤੁਸੀਂ ਅੱਛੀ ਤਰ੍ਹਾਂ ਉਸਨੂੰ ਕਰ ਪਾਓਗੇ ਧੰਨਵਾਦ